ਖਾਣਾ ਬਣਾਉਣ ਤੋਂ ਪਹਿਲਾਂ ਅਸੀਂ ਮਸਾਲੇ ਵਗੈਰਾ ਤਿਆਰ ਕਰਕੇ ਰੱਖ ਸਕਦੇ ਹੈ ਪਿਆਜ ਲਸਣ ਹਰੀਆਂ ਮਿਰਚਾਂ ਅਦਰਕ ਵਗੈਰਾ ਇਹਨਾਂ ਨੂੰ ਪੀਸ ਕੇ ਪਹਿਲੇ ਰੱਖੋ ਫਿਰ ਬਾਅਦ 'ਚ ਟਮਾਟਰ ਪੀਸ ਕੇ ਰੱਖੋ ਉਸ ਤੋਂ ਬਾਅਦ ਕੜਾਹੀ ਚੜਾਓ ਕੜਾਹੀ ਵਿੱਚ ਤੇਲ ਪਾ ਕੇ ਰੱਖੋ ਅਤੇ ਸਬਜ਼ੀਆਂ ਵਗੈਰਾ ਕੱਟ ਕੇ ਰੱਖੋ ਤਾਂ ਕਿ ਸਾਨੂੰ ਖਾਣਾ ਬਣਾਉਣ ਦੇ ਵਿੱਚ ਕੋਈ ਔਖ ਨਾ ਆਵੇ ਇਹ ਤਿਆਰੀ ਪਹਿਲੇ ਕੀਤੀ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਵਧੀਆ ਖਾਣਾ ਬਣਾ ਸਕਦੇ ਹੈ ਅਤੇ ਜਸਟ ਵਧੀਆ ਬਣਾ ਸਕਦੇ ਹਾਂ ਟਮਾਟਰ ਦੀ ਪਿਊਰੀ ਪਹਿਲੇ ਉਹ ਵੀ ਨਮਕ ਵਿੱਚ ਮਸਾਲੇ ਵੀ ਤਿਆਰ ਰੱਖੇ ਹੋਣ ਅਤੇ ਤਾਂ ਕਿ ਸਾਡੀ ਉਹਨਾਂ ਦੀ ਮਾਤਰਾ ਵੀ ਠੀਕ ਠੀਕ ਅਸੀਂ ਉਹਦੇ ਵਿੱਚ ਪਾ ਸਕੀਏ ਅਤੇ ਬਾਅਦ ਚੋਂ ਕੜਾਹੀ ਨੂੰ ਢੱਕ ਕੇ ਵੀ ਰੱਖਣਾ ਚਾਹੀਦਾ ਹੈ ਤਾਂ ਕਿ ਸਬਜ਼ੀ ਵਧੀਆ ਬਣੇ ਅਤੇ ਪਾਣੀ ਦੀ ਵਰਤੋਂ ਜ਼ਿਆਦਾ ਨਾ ਕਰੀਏ ਤਾਂ ਕਿ ਉਹ ਸਟੀਮ ਦੇ ਨਾਲ ਹੀ ਵਧੀਆ ਬਣ ਸਕਣ ਅਤੇ ਹੋਰ ਅਸੀਂ ਮਸਾਲੇ ਮਸੂਲੇ ਵੀ ਪਹਿਲੇ ਬਣਾ ਤਿਆਰ ਕਰਕੇ ਰੱਖੀਏ ਤੇਲ ਜਿਹੜਾ ਜ਼ਿਆਦਾ ਸਾੜ ਕੇ ਪਹਿਲੇ ਹੀ ਰੱਖ ਲਈਏ ਤਾਂ ਕਿ ਸਾਨੂੰ ਬਹੁਤਾ ਟਾਈਮ ਤੇਲ ਸਾੜਨ ਵਿੱਚ ਨਾ ਲੱਗੇ ਅਤੇ ਇਸ ਤੋਂ ਇਲਾਵਾ ਵੀ ਅਸੀਂ ਸਬਜ਼ੀਆਂ ਪਹਿਲੇ ਵੀ ਕੱਟ ਕੇ ਰੱਖ ਸਕਦੇ ਹੈ ਅਤੇ ਤੇਲ ਵੀ ਇੱਕ ਪਾ ਕੇ ਰੱਖ ਸਕਦੇ ਹੈ ਮਸਾਲੇ ਵਗੈਰਾ ਅ ਪਹਿਲੇ ਹੀ ਤਿਆਰ ਹੋਣੇ ਚਾਹੀਦੇ ਆ ਜਿੱਦਾਂ ਮਤਲਬ ਕਿ ਟਮਾਟਰ ਦੀ ਪਿਊਰੀ ਬਣਾਉਣ ਵਾਸਤੇ ਸਾਨੂੰ ਬਾਅਦ ਚੋਂ ਟਾਈਮ ਵੇਸਟ ਨਾ ਕਰਨਾ ਪਵੇ ਸਾਡੀ ਟਮਾਟਰ ਦੀ ਪਿਊਰੀ ਵੀ ਪਹਿਲੇ ਹੀ ਹੋਣੀ ਚਾਹੀਦੀ ਹੈ ਅਤੇ ਸਬਜ਼ੀਆਂ ਵੀ ਕੱਟ ਕੇ ਰੱਖਣੀਆਂ ਪੈਂਦੀਆਂ ਹੈ ਤਾਂ ਕਿ ਅਸੀਂ ਇੱਕ ਮਤਲਬ ਕਿ ਮਸਾਲੇ ਸਾਡੇ ਜ਼ਿਆਦਾ ਮਤਲਬ ਕਿ ਜ਼ਿਆਦਾ ਸੜਨ ਨਾ ਉਹ ਠੀਕ ਟਾਈਮ 'ਤੇ ਭੁੰਨ ਕੇ ਜਦੋਂ ਤੇਲ ਛੁੱਟ ਜਾਵੇ ਤਾਂ ਉਸੇ ਵੇਲੇ ਅਸੀਂ ਕਰ ਸਕੀਏ ਅਤੇ ਇਸ ਤਰ੍ਹਾਂ ਦੇ ਨਾਲ ਸਾਡੀ ਸਬਜ਼ੀ ਬਹੁਤ ਵਧੀਆ ਤਿਆਰ ਹੋ ਸਕਦੀ ਹੈ ਅਤੇ ਮਸਾਲੇ ਵਗੈਰਾ ਬਿਲਕੁਲ ਕੁਆਂਟਿਟੀ ਦੇ ਵਿੱਚ ਸਹੀ ਪਹਿਲੇ ਪਲੇਟ ਵਿੱਚ ਪਾ ਕੇ ਰੱਖ ਲਓ ਅਲੱਗ ਅਸੀਂ ਕਿੰਨਾ ਮਸਾਲਾ ਪਾਉਣਾ ਕਿੰਨੀ ਮਾਤਰਾ ਉਹਦੀ ਪਾਉਣੀ ਹੈ ਪਹਿਲੇ ਪਲੇਟ ਵਿੱਚ ਰੱਖੇ ਹੋਣਗੇ ਤਾਂ ਬਹੁਤ ਵਧੀਆ ਸਬਜ਼ੀ ਬਣੇਗੀ